ਹੈਲੋ ਗੁਡ ਗੁਡ ਮੋਰਨਿੰਗ ਮੈਮ ਮੈਮ ਮੈਂ ਮੈਂ ਸੰਗੀਤਾ ਬੋਲ ਰਹੀ ਹਾਂ ਪਲੀਜ਼ ਤੁਸੀਂ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਤੋਂ ਬੋਲ ਰਹੇ ਓ ਹਾਂ ਤੁਸੀਂ ਇਹਦੇ ਪ੍ਰਿੰਸੀਪਲ ਬੋਲ ਰਹੇ ਹੋ ਹਾਂਜੀ ਮੈਮ ਐਕਚੁਲੀ ਮੇਰਾ ਨਾਮ ਸੰਗੀਤਾ ਹੈ ਅਤੇ ਮੈਂ ਬੀਏ ਬੀ ਐਡ ਕੀਤੀ ਹੋਈ ਹੈ ਅਤੇ ਮੈਂ ਨਾ ਤੁਹਾਡੇ ਸਕੂਲ ਵਿੱਚ ਨਾ ਪੰਜਾਬੀ ਦੀ ਪੋਸਟ ਵਾਸਤੇ ਰਿਜ਼ਿਊਮ ਦੇਣਾ ਚਾਹੁੰਦੀ ਹਾਂ ਮੇਰੀ ਕੁਆ ਅਤੇ ਮੇਰਾ ਨਾ ਮਤਲਬ ਮੈਨੂੰ ਪੱਚੀ ਸਾਲ ਦਾ ਐਕਸਪੀਰੀਅੰਸ ਵੀ ਹੈ ਪ ਅਤੇ ਹਾਂਜੀ ਹਾਂਜੀ ਹਾਂਜੀ ਮੈਮ ਐਕਚੁਲੀ ਮੈਂ ਪੰਜ ਸਾਲ ਦਾ ਐਕਸਪੀਰੀਅੰਸ ਮੈਨੂੰ ਬਿਫੋਰ ਮੈਰਿਜ ਹੈ ਅਤੇ ਆਫਟਰ ਮੈਰਿਜ ਵੀ ਮੈਨੂੰ ਐਕਸਪੀਰੀਅੰਸ ਸੀਗਾ ਮੈਂ ਗੁਰੂ ਅੰਗਦ ਦੇਵ ਸਕੂਲ ਵਿੱਚ ਲੱਗੀ ਸੀ ਠੀਕ ਹੈ ਅਤੇ ਪੰਜ ਸਾਲ ਪਹਿਲੇ ਮੈਂ ਜੋਬ ਕੀਤੀ ਹੈ ਬਿਫੋਰ ਮੈਰਿਜ ਅੰਮ੍ਰਿਤਸਰ ਸਕੂਲ ਹੈਗਾ ਸੰਤ ਬਾਬਾ ਭੂਰੀ ਵਾਲਿਆਂ ਦਾ ਐਜ ਏ ਪੰਜਾਬੀ ਟੀਚਰ ਅਤੇ ਤੁਹਾਡੇ ਤੁਹਾਡੇ ਸਕੂਲ ਵੀ ਮੈਡਮ ਹੈ ਪੰਜਾਬੀ ਟੀਚਰ ਵਾਸਤੇ ਅਪਲਾਈ ਕਰਨਾ ਚਾਹੁੰਦੀ ਹਾਂ ਮੈਂ ਤੁਹਾਡੇ ਸਕੂਲ ਬਾਰੇ ਬਹੁਤ ਕੁਝ ਸੁਣਿਆ ਹੈਗਾ ਏ ਕਿ ਬਹੁਤ ਵਧੀਆ ਸਕੂਲ ਹੈ ਅਤੇ ਜੇ ਹਾਂ ਜੀ ਇਹ ਮੈਨੂੰ ਤਾਂ ਮੈਡਮ ਯਸ ਮੈਮ ਹਾਂਜੀ ਐਕਚੁਲੀ ਮੈਮ ਮੈਂ ਨਾ ਨਿਊਜ਼ਪੇਪਰ ਵਿੱਚ ਪੜ੍ਹਿਆ ਸੀ ਤੁਹਾਡੀ ਐਡ ਅਤੇ ਇਸ ਕਰਕੇ ਮਤਲਬ ਮੈਂ ਪੁੱਛਣਾ ਚਾਹੁੰਦੀ ਸੀ ਕਿ ਤੁਹਾਡੇ ਸਕੂਲ ਵਿੱਚ ਮਤਲਬ ਇੰਟਰਵਿਊ ਕਦੋਂ ਹੈ ਤਾਂ ਕਿ ਮੈਂ ਸਕੂਲ ਆ ਕੇ ਆਪਣਾ ਰਿਜਿਊਮ ਡਿਪੋਜਿਟ ਕਰ ਸਕਾਂ ਔਰ ਪਲੱਸ ਇੰਟਰਵਿਊ ਵਿੱਚ ਵੀ ਸ਼ਾਮਿਲ ਹੋ ਸਕਾਂ ਤਾਂ ਕਿ ਮੈਨੂੰ ਤੁਹਾਡੇ ਸਕੂਲ ਵਿੱਚ ਸੇਵਾ ਕਰਨ ਦਾ ਮੌਕਾ ਦਿਓ ਇੱਕ ਕਿ ਮੈਂ ਐਕਸਪੀਰੀਅੰਸ ਟੀਚਰ ਹਾਂ ਪਲੱਸ ਮੈਂ ਪੰਜਾਬੀ ਦੀ ਟੀਚਰ ਹਾਂ ਔਰ ਪਲੱਸ ਮੇਰਾ ਐਕਸਪੀਰੀਅੰਸ ਵੀ ਹੈਗਾ ਔਰ ਮੈਨੂੰ ਵੈਸੇ ਵੀ ਮਿਊਜਿਕ ਔਰ ਦੂਸਰੀਆਂ ਐਕਟੀਵਿਟੀਜ ਦਾ ਕਾਫੀ ਸ਼ੌਂਕ ਹੈ ਰੀਡਿੰਗ ਦਾ ਕਾਫੀ ਸ਼ੌਂਕ ਹੈ ਅਤੇ ਪਲੀਜ਼ ਮੈਨੂੰ ਦੱਸ ਸਕੋਗੇ ਕਿ ਮੈਂ ਕਦੋਂ ਤੁਹਾਡੇ ਸਕੂਲ ਵਿੱਚ ਆ ਸਕਦੀ ਹਾਂ ਵਿਜਿਟ ਕਰਨ ਠੀਕ ਠੀਕ ਥੈਂਕ ਯੂ ਸੋ ਮੱਚ ਮੈਮ ਓਕੇ ਓਕੇ ਮੈਮ